ਸਾਡਾ ਧਰਮ ਸਾਨੂੰ ਜਿੱਦਾਂ ਕਿ ਸਮਾਜ ਸੇਵਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਿਖਾਉਂਦਾ ਹੈ ਕਿ ਅਗਰ ਕੋਈ ਗਰੀਬ ਬਜ਼ੁਰਗ ਜਾਂ ਕੋਈ ਗਰੀਬ ਧੀ ਭੈਣ ਹੈ ਜਿਹਦਾ ਕਿ ਮਤਲਬ ਕਿ ਕੋਈ ਵਿਆਹ ਕਾਰਜ ਨਹੀਂ ਹੋ ਰਿਹਾ ਜਾਂ ਜਿੱਦਾਂ ਕਿ ਗ ਗਰੀਬ ਬਜ਼ੁਰਗਾਂ ਦੀ ਗੱਲ ਕਰੀਏ ਗਰੀਬ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਹੁੰਦੀ ਹੈ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਡਾ ਧਰਮ ਹਮੇਸ਼ਾ ਇਹ ਹੀ ਸਿਖਾਉਂਦਾ ਹੈ ਕਿ ਉਸ ਗਰੀਬ ਦੀ ਹੈਲਪ ਕੀਤੀ ਜਾਵੇ ਉਸ ਨੂੰ ਕੱਪੜੇ ਬਣਾ ਕੇ ਦਿੱਤੇ ਜਾਣ ਅਤੇ ਉਹਨਾਂ ਨੂੰ ਮੈਡੀਸਨ ਸਹੂਲਤ ਦਿੱਤੀ ਜਾਵੇ ਕਈ ਗੁਰਦੁਆਰਿਆਂ ਦੇ ਵਿੱਚ ਹੋਸਪਿਟਲ ਚੱਲਦੇ ਨੇ ਅਤੇ ਉੱਥੋਂ ਕੋਈ ਵੀ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਫਰੀ ਮੈਡੀਸਨ ਪ੍ਰਾਪਤ ਕਰਦਾ ਹੈ ਸੋ ਇਹ ਸ ਅਸੀਂ ਧਰਮ ਤੋਂ ਸਿੱਖਿਆ ਹੈ ਦੂਸਰੀ ਗੱਲ ਅਗਰ ਕੋਈ ਭੁੱਖਾ ਹੈ ਕੋਈ ਰੋਟੀ ਨਹੀਂ ਖਾ ਸਕਦਾ ਤਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੰਗਰ ਚੱਲਦੇ ਨੇ ਉੱਥੋਂ ਕੋਈ ਭਾਵੇਂ ਪੰਜ ਵਾਰ ਲੰਗਰ ਛਕੇ ਛੇ ਵਾਰ ਛਕੇ ਕਿਸੇ ਤੋਂ ਕੋਈ ਫੀਸ ਨਹੀਂ ਅਦਾ ਕਰਵਾਈ ਜਾਂਦੀ ਦੂਸਰੀ ਗੱਲ ਤੀਸਰੀ ਗੱਲ ਇਹ ਹੈ ਕਿ ਅਗਰ ਕੋਈ ਪਿੰਡ ਦੇ ਵਿੱਚ ਅ ਕੋਈ ਗਰੀਬ ਭੈਣ ਹੈ ਜਿਸ ਦਾ ਕਿ ਅਸੀਂ ਵਿਆਹ ਕਰਨਾ ਹੋਵੇ ਤਾਂ ਸਾਡੇ ਸਿੱਖ ਧਰਮ ਦੇ ਲੋਕ ਜਿਹੜੇ ਅ ਕੁਛ ਕੁ ਇਕੱਠੇ ਹੋ ਕੇ ਉਸ ਭੈਣ ਦਾ ਵਿਆਹ ਕਰਦੇ ਨੇ ਉਹਨੂੰ ਬਣਦਾ ਉਹਦਾ ਸਮਾਨ ਦਿੱਤਾ ਜਾਂਦਾ ਹੈ ਐਂਡ ਉਸ ਪਰਿਵਾਰ ਦਾ ਮਤਲਬ ਕਿ ਸੋਚਿਆ ਜਾਂਦਾ ਹੈ ਅਗਰ ਕੋਈ ਗਰੀਬ ਪਰਿਵਾਰ ਅ ਪਰਿਵਾਰ ਦਾ ਕੋਈ ਘਰ ਨਹੀਂ ਬਣ ਰਿਹਾ ਕੋਈ ਛੱਤ ਨਹੀਂ ਪੈ ਰਹੀ ਘਰ ਦੀ ਤਾਂ ਸਾਡੇ ਧਰਮ ਦੇ ਲੋਕ ਆ ਜਿਹੜੇ ਉਹ ਇਕੱਠੇ ਹੋ ਕੇ ਉਸ ਗਰੀਬ ਦੀ ਮਦਦ ਕਰਦੇ ਹਨ ਉਸ ਦੀ ਹੈਲਪ ਕਰਦੇ ਹਨ ਉਸ ਦੀ ਆਰਥਿਕ ਪੱਖੋਂ ਵੀ ਹੈਲਪ ਕਰਦੇ ਹਨ ਅਤੇ ਸੋ ਇਹ ਕਿਸੇ ਗਰੀਬ ਦਾ ਕਿਸੇ ਗਰੀਬ ਬੱਚੀ ਦਾ ਵਿਆਹ ਕਰ ਦੇਣਾ ਕਿਸੇ ਬਜ਼ੁਰਗ ਨੂੰ ਕੱਪੜੇ ਲੀੜੇ ਲੈ ਕੇ ਦੇ ਦੇਣਾ ਮੈਡੀਸਨ ਦੇ ਦੇਣਾ ਐਂਡ ਉਹਦਾ ਖਿਆਲ ਰੱਖਣਾ ਕਿਸੇ ਭੁੱਖੇ ਨੂੰ ਉਹਨੂੰ ਰੋਟੀ ਦੇਣਾ ਇਹ ਧਰਮ ਇਹ ਸਾ ਸਾਨੂੰ ਸਮਾਜ ਸੇਵਾ ਦੇ ਤਰੀਕੇ ਸਿਖਾਉਂਦਾ ਹੈ